ਹੈਲੋ ਹਾਂਜੀ ਨਮਸਕਾਰ ਮੈਡਮ ਹਾਂਜੀ ਤੁਸੀਂ ਏਕਤਾ ਬੋਲਦੇ ਹੋ ਪੰਜਾਬ ਤੋਂ ਹਾਂਜੀ ਮੈਡਮ ਮੈਨੂੰ ਨਾ ਅਸਲ 'ਚ ਮੇਰੇ ਫਰੈਂਡ ਨੇ ਨੰਬਰ ਦਿੱਤਾ ਸੀ ਤੁਹਾਡਾ ਮੈਨੇ ਨਾ ਪੰਜਾਬ ਆਉਣਾ ਸੀ ਮੈਨੂੰ ਜ਼ਿਆਦਾ ਨਹੀਂ ਪਤਾ ਹੈਗਾ ਵੀ ਕਿੱਧਰ ਦੀ ਕਿਵੇਂ ਆਉਣਾ ਅਤੇ ਉੱਥੇ ਕੀ ਕੀ ਜਾਣ ਆਉਣ ਲਈ ਵਧੀਆ ਰਹੇਗੀ ਟ੍ਰਾਂਸਪੋਟ ਲਈ ਮੈਨੂੰ ਉਹਦੇ ਬਾਰੇ ਥੋਤੋਂ ਥੋੜ੍ਹੀ ਜਿਹੀ ਨੌਲੇਜ ਲੈਣੀ ਸੀ ਤੁਸੀਂ ਦੱਸ ਸਕਦੇ ਹੋ ਮੈਨੂੰ ਮੈਡਮ ਮੈਂ ਜੰਮੂ ਤੋਂ ਬੋਲ ਰਹੀ ਹਾਂ ਮੋਨਿਕਾ ਜੀ ਹਾਂਜੀ ਹਾਂਜੀ ਅਸਲ 'ਚ ਨਾ ਮੈਡਮ ਮੈਨੇ ਪਹਿਲਾਂ ਅੰਮ੍ਰਿਤਸਰ ਅੰਮ੍ਰਿਤਸਰ ਪਹੁੰਚਣਾ ਮੈਨੇ ਪਹਿਲਾਂ ਤੁਸੀਂ ਮੈਨੂੰ ਹਾਂਜੀ ਮੇਰੇ ਨਾਲ ਮੇਰੀ ਟੀਮ ਹੈ ਮੈਡਮ ਦੋ ਮੈਂਬਰ ਹੋਰ ਹੈ ਅਸੀਂ ਤਿੰਨ ਜਣੇ ਹੈ ਇੱਕ ਮੇਲ ਹੈ ਇੱਕ ਫੀਮੇਲ ਹੈ ਉਹ ਕੋਈ ਚੱਕਰ ਨਹੀਂ ਹੋਣਾ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਮਤਲਬ ਸਾਨੂੰ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਮੈਡਮ ਔਰ

ਮਤਲਬ ਅਸੀਂ ਆਪਣਾ ਇੱਧਰ ਆ ਕੇ ਪੰਜਾਬ ਦੇ ਵਿੱਚ ਅਸੀਂ ਆਪਣਾ ਸਾਧਨ ਤੋਂ ਬਿਨਾ ਬੱਸਿਸ 'ਤੇ ਸਫ਼ਰ ਕਰ ਸਕਦੇ ਹਾਂ ਬੈਸਟ ਹੈ ਔਰ ਟਾਈਮਿੰਗ ਵਗੈਰਾ ਦੀ ਕੋਈ ਦਿੱਕਤ ਮਤਲਬ ਸੇਫ ਹੈ ਟਾਈਮ 'ਤੇ

ਠੀਕ ਹੈ ਜੀ ਬਸ ਐਂਈਂ ਸੀ ਵੀ ਸਾਡੇ ਕੋਲ ਟਾਈਮ ਘੱਟ ਹੋਊ ਅਸੀਂ ਸਾਨੂੰ ਕੰਮ ਜ਼ਿਆਦਾ ਨੇ ਹੈਗੇ ਤਾਂ ਸਾਡੇ ਕੋਲ ਚਾਰ ਦਿਨ ਹੈਂਗੇ ਅੰਮ੍ਰਿਤਸਰ ਤੋਂ ਅਸੀਂ ਇੱਧਰ ਫੇਰ ਇੱਧਰ ਲੁਧਿਆਣਾ ਸਾਈਡ ਵੀ ਆਉਣਾ ਐਗਾ ਹਾਂਜੀ ਠੀਕ ਹੈ ਚਲੋ ਟਰੇਨ ਨਾਲੋਂ ਮੈਡਮ ਬੱਸ ਵਾਲਾ ਵੀ ਸਹੀ ਲੱਗ ਰਿਹਾ ਅਗਰ ਤੁਸੀਂ ਹਾਂ ਅਗਰ ਕੋਈ ਦਿੱਕਤ ਆਈ ਵੀ ਤਾਂ ਆਪਾਂ ਜੇ ਆਪਣਾ ਕੋਈ ਪਰਸਨਲ ਟਰਾਂਸਪੋਟ ਕਰਨਾ ਵੀ ਹੋਇਆ ਹਾਇਰ ਆਪਾਂ ਕਰ ਸਕਦੇ ਹਾਂ ਕਿਤੇ ਮੈਡਮ ਹਾਂ ਆਂਈਂ ਪੁੱਛ ਰਹੇ ਸੀ ਨਾ ਕਈ ਵਾਰ ਮੌਸਮ ਦਾ ਨਹੀਂ ਪਤਾ ਲੱਗਦਾ ਹੈ ਨਾ ਕਈ ਵਾਰ ਕਿਤੇ ਜਾਂਦੇ ਹਾਂ ਟਾਈਮ ਲੱਗ ਜਾਂਦਾ ਵੀ ਠੀਕ ਹੈ ਮੈਡਮ ਉਹ ਨੰਬਰ ਵਗੈਰਾ ਤੁਹਾਡੇ ਕੋਲ ਹੋਣਗੇ ਜੇ ਸਾਨੂੰ ਜ਼ਰੂਰਤ ਪਈ ਅਸੀਂ ਉਦੋਂ ਕਰ ਲਈਏ

ਠੀਕ ਹੈ ਮੈਡਮ ਹਾਂਜੀ

ਠੀਕ ਹੈ ਜੀ ਠੀਕ ਹੈ ਮੈਡਮ ਕੋਈ ਗੱਲ ਨਹੀਂ ਜੇ ਦਿੱਕਤ ਪਈ ਤਾਂ ਤੁਹਾਨੂੰ ਫਿਰ ਕਸ਼ਟ ਦੇਵਾਂਗੇ ਫੋਨ ਕਰਨ ਦਾ ਹਾਂਜੀ ਹਾਂਜੀ ਠੀਕ ਹੈ ਜੀ ਥੈਂਕ ਯੂ ਮੈਡਮ ਓਕੇ